ਸਮਾਜ ਨੂੰ ਚੰਗੀ ਸੇਧ ਦੇਣ ਵਾਲੀਆਂ ਫਿਲਮਾਂ ਮੈਨੂੰ ਪਸੰਦ ਨੇ ਇਹ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਬਹੁਤ ਸਾਰੀਆਂ ਸਮੱਸਿਆ ਨਾਲ ਜੂਝ ਰਿਹਾ ਹੈ ਅੱਜ ਦੀ ਤਨਾਵ ਭਰੀ ਜ਼ਿੰਦਗੀ ਵਿੱਚ ਕਮੇਡੀ ਅਤੇ ਮੰਨੋਰੰਜਕ ਫਿਲਮਾਂ ਦੀ ਆਪਣੀ ਮਹਾਨਤਾ ਹੈ ਪਰ ਫਿਰ ਵੀ ਮੈਨੂੰ ਸਮਾਜ ਨੂੰ ਚੰਗਾ ਸੁਨੇਹਾ ਦੇਣ ਵਾਲੀਆਂ ਫਿਲਮਾਂ ਮੈਨੂੰ ਪਸੰਦ ਪਿੱਛੇ ਜਿਹੇ ਮਿੱਟੀ ਫਿਲਮ ਦੇਖੀ ਜਿੱਥੇ ਕਿ ਇੱਕ ਕਿਸਾਨਾਂ ਦੇ ਕਿਸਾਨਾਂ ਨਾਲ ਜੋ ਕਾਰਪੋਰੇਟ ਹੈਗੇ ਉਹ ਉਹਨਾਂ ਦੀ ਜ਼ਮੀਨਾਂ 'ਤੇ ਜੋ ਹੈ ਕਬਜ਼ਾ ਕਰਨਾ ਚਾਹੁੰਦਾ ਹੈ ਉਹ ਫਿਲਮ ਵੀ ਇੱਕ ਚੰਗੀ ਸੇਧ ਦੇਣ ਵਾਲੀ ਸੀ ਇਸ ਤੋਂ ਇਲਾਵਾ ਇੱਕ ਅਰਦਾਸ ਫਿਲਮ ਦੇਖੀ ਉਹ ਬਹੁਤ ਚੰਗੀ ਲੱਗੀ ਅਤੇ ਪਿੱਛੇ ਜਿਹੇ ਹ ਹੁਣੇ ਮਸਤਾਨੇ ਫਿਲਮ ਆਈ ਇਹ ਧਾਰਮਿਕ ਤੌਰ 'ਤੇ ਮੈਨੂੰ ਬਹੁਤ ਚੰਗੀ ਫਿਲਮ ਲੱਗੀ ਅਤੇ ਇਸ ਕਰਕੇ ਮੈਨੂੰ ਜਿਹੜੀਆਂ ਹੈਗੀਆਂ ਸਮਾਜ ਨੂੰ ਜਿਹੜੀਆਂ ਵੀ ਚੰਗਾ ਮੈਸੇਜ ਦੇਣ ਵਾਲੀਆਂ ਚੰਗੀਆਂ ਸੁਨੇਹਾ ਦੇਣ ਵਾਲੀਆਂ ਫਿਲਮਾਂ ਜਿਹੜੀਆਂ ਮੈਨੂੰ ਪਸੰਦ ਨੇ